ਸ਼ੌਂਕ ਵਜੋਂ ਫੋਟੋਗ੍ਰਾਫੀ ਸ਼ੌਂਕ ਇੱਦਾਂ ਸਟਾਰਟ ਹੋਇਆ ਮਤਲਬ ਕਿ ਅਸੀਂ ਫੇਸਬੁਕ ਚਲਾਉਣੀ ਸਟਾਰਟ ਕਰੀ ਜਦੋਂ ਉਸ ਟਾਈਮ ਅਸੀਂ ਕੁਦਰਤ ਦੀਆਂ ਬਹੁਤ ਸੋਹਣੀ ਸੋਹਣੀਆਂ ਫੋਟੋਆਂ ਦੇਖਦੇ ਸੀ ਅਤੇ ਉਸ ਤੋਂ ਹੀ ਅਸੀਂ ਸਾਡਾ ਬੜਾ ਸ਼ੌਂਕ ਸੀ ਮੈਂ ਅਤੇ ਮੇਰਾ ਦੋਸਤ ਸੀ ਵਿਕਾਸ ਅਸੀਂ ਇੱਕ ਰਿਆਤ ਸਕੂਲ ਦੇ ਵਿੱਚ ਪੜ੍ਹਦੇ ਸੀ ਉੱਥੇ ਤੋਂ ਹੀ ਸਾਨੂੰ ਇੱਕ ਤਰ੍ਹਾਂ ਦਾ ਇੱਕ ਦੂਜੇ ਨੂੰ ਚੈਲੰਜ ਦੇਣ ਦਾ ਬੜਾ ਸ਼ੌਂਕ ਚਡ ਚੜ੍ਹ ਗਿਆ ਕਿਆ ਦੇਖਿਆ ਮੈਂ ਫੋਟੋ ਪਾਈ ਜਦੋਂ ਦੇ ਕਿੰਨੀ ਸੋਹਣੀ ਬਣਾਈ ਆਹ ਦੇਖ ਸਲੋਅ ਮੋਸ਼ਨ 'ਚ ਕਿੰਨੀ ਸੋਹਣੀ ਫੋਟੋ ਖਿੱਚ ਹੋਈ ਡਿਟੇਲਿੰਗ ਦੇਖ ਤੂੰ ਬਰਾਈਟਨੈੱਸ ਦੇਖ ਕਿੰਨੀ ਵਧੀਆ ਬਣਾਈ ਫੋਟੋ ਫੋਕਸ ਕਿੰਨਾ ਵਧੀਆ ਹੋਇਆ ਫੋਟੋ 'ਚ ਉਸ ਤਰੀਕੇ ਨਾਲ ਕਿਹਾ ਕਿ ਬੜਾ ਸ਼ੌਂਕ ਜਿਹਾ ਹੌਲੀ ਹੌਲੀ ਜਾਗਣ ਲੱਗ ਪਿਆ ਵਧੀਆ ਲੱਗਣਾ ਪਿਆ ਫੋਟੋ ਖਿੱਚਣ ਨੂੰ ਕਿਹੜੇ ਬਹੁਤਾ ਟਾਈਮ ਲੱਗਦਾ ਪਰ ਇਹ ਥੋੜ੍ਹੀ ਸਕਿੱਲ ਹੁੰਦੀ ਕੁਛ ਚੀਜ਼ਾਂ ਦਾ ਕਾਫ਼ੀ ਜ਼ੋਰ ਧਿਆਨ ਰੱਖਣਾ ਪੈਂਦਾ ਜਦੋਂ ਵੀ ਕਿਤੇ ਕੁਦਰਤੀ ਵਿਊ 'ਚ ਜਾਣਾ ਕਿਉਂਕਿ ਅਸੀਂ ਕੁਦਰਤੀ ਵਿਊ ਦੇ ਵਿੱਚੋਂ ਹੀ ਲੰਘ ਕੇ ਸਕੂਲ ਜਾਂਦੇ ਸੀ ਦਿਲ ਕਰਦਾ ਸੀ ਇਸ ਵਿਊ ਨੂੰ ਬਸ ਆਪਣੇ ਅੱਖਾਂ 'ਚ ਕੈਦ ਕਰ ਲਈਏ ਉਸ ਕੈਦ ਦੇ ਚੱਕਰ 'ਚ ਹੀ ਬਸ ਇਹ ਕੰਮ ਸਟਾਰਟ ਹੋ ਗਿਆ ਮੈਂ ਅਤੇ ਮੇਰਾ ਦੋਸਤ ਅਸੀਂ ਫੋਟੋ ਖਿੱਚਣੀਆਂ ਸਟਾਰਟ ਕੀਤੀਆਂ ਹੁਣ ਤਾਂ ਉਸ ਨਾਲ ਮੇਲਜੋਲ ਬਹੁਤ ਘੱਟ ਹੁੰਦਾ ਪਰ ਜਦੋਂ ਸਭ ਤੋਂ ਪਹਿਲਾਂ ਫੋਟੋਆਂ ਅਸੀ ਹੋਈ ਖਿੱਚਦੇ ਹਾਂ ਫੁੱਲਾਂ ਦੀਆਂ ਕੋਈ ਕਣਕਾਂ ਦੀਆਂ ਖੇਤਾਂ ਦੀਆਂ ਪੱਤਿਆਂ ਦੀਆਂ ਸੰਨਸੈਟ ਦੀਆਂ ਜਾਂ ਫਿਰ ਸੂਰਜ ਡੁੱਬਦਾ ਸੂਰਜ ਚੜ੍ਹਦਾ ਬੱਦਲਾਂ ਦੀਆਂ ਇਸ ਤਰ੍ਹਾਂ ਹੀ ਸਾਰਾ ਕੰਮ ਸਟਾਰਟ ਹੋਇਆ ਅਤੇ ਹੌਲੀ ਹੌਲੀ ਇਹਦਾ ਬੜਾ ਸ਼ੌਂਕ ਪੈ ਗਿਆ ਸਭ ਤੋਂ ਬੜੀ ਪ੍ਰੇਰਣਾ ਇਹ ਰਹੀ ਕਿ ਬਹੁਤ ਸਾਰੇ ਮੈਂ ਫੋਟੋਗ੍ਰਾਫਰ ਦੇਖੇ ਜਿਹੜੇ ਕਿ ਆਪਣੀ ਵਰਲਡ ਲਾਈਫ ਦੀ ਫੋਟੋ ਖਿੱਚਦੇ ਸੀ ਉਹਨਾਂ ਤੋਂ ਦੇਖ ਕੇ ਸਾਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਵੀ ਇੱਦਾਂ ਦੀਆਂ ਫੋਟੋ ਖਿੱਚ ਸਕਦੇ ਹਾਂ ਹਾਂ ਉਸ ਲੈਵਲ ਤੱਕ ਹਜੇ ਫਿਲਹਾਲ ਤਾਂ ਨਹੀਂ ਪਹੁੰਚੇ ਪਰ ਜ਼ਰੂਰ ਪਹੁੰਚਾਂਗੇ ਇਹਦੇ ਨਾਲ ਹੀ ਬਹੁਤ ਸਾਰੀਆਂ ਹੋਰ ਵੀ ਸ਼ੌਂਕ ਪੈਦਾ ਕਰਨ ਵਾਲੀਆਂ ਇਹ ਚੀਜ਼ਾਂ ਸਨ ਸਭ ਤੋਂ ਵਧੀਆ ਬੜੀ ਚੀਜ਼ ਸੀ ਪਹਾੜਾਂ ਵੱਲ ਜਾਣਾ ਪਹਾੜਾਂ ਨੇ ਬੜਾ ਹੀ ਦਿਲ ਖਿੱਚਵਾਂ ਨਜ਼ਾਰਾ ਦਿੱਤਾ